ਮੈਨੂੰ ਆਨਲਾਈਨ ਸ਼ੋਪਿੰਗ 'ਤੇ ਪਹਿਲਾਂ ਹੀ ਨਹੀਂ ਟਰੱਸਟ ਸੀਗਾ ਕਿਉਂਕਿ ਮੈਨੂੰ ਕਦੇ ਮੈਂ ਆਨਲਾਈਨ ਕੁਛ ਮੰਗਾ ਕੇ ਨਹੀਂ ਦੇਖਿਆ ਸੀਗਾ ਮੈਨੂੰ ਸੀਗਾ ਕਿ ਜਿਸ ਦਿਨ ਮੈਂ ਪਾਉਣਾ ਸੀ ਉਸ ਦਿਨ ਆਇਆ ਨਹੀਂ ਮੈਂ ਰੱਦ ਕਰਾਉਣਾ ਅਤੇ ਮੈਨੂੰ ਪਤਾ ਹੀ ਨਹੀਂ ਕਿਵੇਂ ਰੱਦ ਕਰਵਾਇਆ ਜਾਂਦਾ ਕਿਉਂਕਿ ਮੈਂ ਪਹਿਲੀ ਵਾਰ ਕੁਝ ਮੰਗਾਇਆ ਸੀਗਾ ਅਤੇ ਪਹਿਲੀ ਵਾਰ ਹੀ ਮੈਨੂੰ ਇੰਨਾਂ ਬੁਰਾ ਲੱਗਿਆ ਕਿ ਟਾਈਮ 'ਤੇ ਹੀ ਨਹੀਂ ਆਇਆ ਫਿਰ ਮੈਨੂੰ ਮੈਂ ਹੈਲਪਲਾਈਨ ਨੰਬਰ 'ਤੇ ਕਾਲ ਕੀਤੀ ਉਹਨਾਂ ਨੂੰ ਪੁੱਛਿਆ ਮੈਂ ਕਈ ਹੋਰ ਲੋਕਾਂ ਨੂੰ ਪੁੱਛਿਆ ਕਿਵੇਂ ਰੱਦ ਕੀਤਾ ਜਾਂਦਾ ਅਤੇ ਮੇਰਾ ਐਕਸਪੀਰੀਅੰਸ ਬੜਾ ਬੇਕਾਰ ਰਿਹਾ ਇਹਨਾਂ ਨਾਲ ਕਿ ਆਨਲਾਈਨ ਚੀਜ਼ਾਂ ਨਾਲ ਮੈਂ ਅੱਗੇ ਤੋਂ ਧਿਆਨ ਰੱਖ ਕੇ ਹੀ ਮੰਗਾਵਾਂਗੀ ਅਤੇ ਹੁਣ ਮੈਂ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਪੁੱਛਿਆ ਕਿਵੇਂ ਰੱਦ ਕੀਤਾ ਜਾਂਦਾ ਅਤੇ ਉਹਨਾਂ ਨੂੰ ਮੈਂ ਫੋਨ ਕੀਤਾ ਉਹਨਾਂ ਨੂੰ ਕਿਹਾ ਜੇ ਮੇਰੇ ਪੈਸੇ ਵਾਪਸ ਮੁੜ ਸਕਦੇ ਹਨ ਤਾਂ ਕਰ ਦੇਣ ਕਿਉਂਕਿ ਮੈਂ ਪਹਿਲਾਂ ਹੀ ਚੀਜ਼ ਲੈਣ ਦਾ ਆਰਡਰ ਕਰਨ ਤੋਂ ਪਹਿਲਾਂ ਹੀ ਪੈਸੇ ਪੇਮੈਂਟ ਕਰ ਚੁੱਕੀ ਸੀ ਤਾਂ ਕੀ ਮੈਨੂੰ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਹੁਣ ਉਹ ਹੈਲਪਲਾਈਨ ਨੰਬਰ ਵਾਲੇ ਕਹਿ ਰਹੇ ਨੇ ਕਿ ਦੇਖਦੇ ਹਾਂ ਹੁਣ ਅਸੀਂ ਜੇ ਕੁਝ ਹੋ ਸਕਦਾ ਤਾਂ ਮੈਂ ਕਿਹਾ ਜ਼ਰੂਰ ਕਰਕੇ ਦਿਓ ਬਿਕੋਜ਼ ਕਾਫੀ ਮਹਿੰਗਾ ਸੀਗਾ ਜੋ ਮੈਂ ਕੁੜਤਾ ਮੰਗਾਇਆ ਸੀਗਾ ਹੁਣ ਹੈਲਪਲਾਈਨ ਨੰਬਰ 'ਤੇ ਕੀਤਾ ਦੇਖੋ ਕੀ ਕਹਿੰਦੇ ਨੇ ਉਹ ਬਾਕੀ ਮੈਨੂੰ ਇੰਨਾਂ ਪਤਾ ਨਹੀਂ ਹੈਗਾ ਬਟ ਮੈਂ ਫਿਰ ਵੀ ਉਹਨਾਂ ਨੂੰ ਕਿਹਾ ਵਾ ਜੇ ਮੇਰਾ ਆਰਡਰ ਹੋ ਸਕਦਾ ਵਾਪਸ ਤਾਂ ਪਲੀਜ਼ ਕਿਰਪਾ ਕਰਕੇ ਕਰ ਦਿੱਤਾ ਜਾਵੇ